ਭੰਗੜੇ ਦੇ ਕੁਛ ਆਮ ਸਟੈਪ ਕੀ ਹਨ ਅਤੇ ਉਹ ਪੰਜਾਬੀ ਸੱਭਿਆਚਾਰ ਦੀ ਜ਼ੋਰਦਾਰ ਅਤੇ ਜਸ਼ਨ ਵਾਲੇ ਸੁਭਾਅ ਵਿੱਚ ਕਿਵੇਂ ਯੋਗਦਾਨ ਪਾਉਂਦੇ ਹਨ ਹਾਂਜੀ ਗੱਲ ਕਰੀਏ ਜੇ ਭੰਗੜੇ ਦੇ ਕੁਛ ਆਮ ਸਟੈੱਪਾਂ ਬਾਰੇ ਤਾਂ ਸਭ ਤੋਂ ਪਹਿਲਾਂ ਤਾਂ ਜੋ ਭੰਗੜਾ ਗਾ ਜਿਵੇਂ ਕਹਿੰਦੇ ਭੰਗੜਾ ਪੈਂਦਾ ਪੱਟਾਂ ਦੇ ਜ਼ੋਰ ਨਾਲ ਤਾਂ ਸਰੀਰ ਵੀ ਇਹਦੇ ਵਿੱਚ ਵਧੀਆ ਬਣਿਆ ਹੋਣਾ ਚਾਹੀਦਾ ਤਕੜਾ ਬਣਿਆ ਜਾਂਦਾ ਪੱਟਾਂ ਦਾ ਕਿਉਂਕਿ ਜ਼ੋਰ ਲੱਗਦਾ ਲੱਤਾਂ ਦਾ ਜ਼ੋਰ ਲੱਗਦਾ ਹੈਗਾ ਤਾਂ ਉਸ ਮੁਤਾਬਿਕ ਜਾ ਸਕਦਾ ਹੈਗਾ ਤਾਂ ਇਹਦੇ ਵਿੱਚ ਸਭ ਤੋਂ ਪਹਿਲਾਂ ਜਿਹੜਾ ਬੰਦਾ ਗਾ ਰਿਸ਼ਟ ਪੁਸ਼ਟ ਹੋਵੇ ਤੰਦਰੁਸਤ ਹੋਵੇ ਸਰੀਰ ਦਾ ਹੋਵੇ ਕਿਉਂਕਿ ਜੇ ਇੱਕ ਬਿਮਾਰ ਬੰਦਾ ਨਹੀਂ ਸਗੋਂ ਇੱਕ ਤੰਦਰੁਸਤੀ ਵਿਅਕਤੀ ਹੈਗਾ ਅਤੇ ਵਧੀਆ ਉਹ ਭਰਮਾਂ ਗਾ ਤਾਂ ਉਹ ਭੰਗੜਾ ਬਹੁਤ ਵਧੀਆ ਪਾ ਸਕਦਾ ਹੈਗਾ ਜੇ ਉਹਦੇ ਮੁਕਾਬਲੇ 'ਚ ਉਹਦੇ ਵਿੱਚ ਪੱਟਾਂ ਦਾ ਜਾਂ ਲੱਤਾਂ ਦੇ ਭਰਮੀਆਂ ਨੇਗੀਆਂ ਸਰੀਰ ਭਰਮਾਂ ਕਰ ਭੰਗੜਾ ਜਿਹੜਾ ਸਜਦਾ ਵੀ ਹੈਗਾ ਬਹੁਤ ਵਧੀਆ ਲੱਗਦਾ ਹੈਗਾ ਇਹਦੇ ਜਿਹੜੇ ਸਟੈੱਪ ਨੇਗੇ ਆਮ ਉਹਦੇ ਵਿੱਚ ਲੱਤਾ ਦੇ ਸਟੈਪ ਹੁੰਦੇ ਨੇਗੇ ਕਈ ਵਾਰ ਤਾਂ ਇਸ ਭੰਗੜੇ ਦੀਆਂ ਅਲੱਗ ਅਲੱਗ ਕਿਸਮਾਂ ਨੇਗੀਆਂ ਜਾਂ ਅਲੱਗ ਅਲੱਗ ਉਹ ਹੋਣਗੀਆਂ ਬਣ ਗਈਆਂ ਨੇਗੀਆਂ ਕਈ ਵਾਰ ਦੇ ਵਿੱਚ ਇੱਕ ਲੱਤ ਚੱਕ ਕੇ ਉਸ ਦ ਉਹ ਲੱਤ ਚੱਕ ਕੇ ਉਹਦੇ ਉੱਪਰ ਇੱਕ ਲੱਤ ਖੜ੍ਹੀ ਕਰਕੇ ਉਹਦੇ ਆਲੇ ਦੁਆਲੇ ਘੁੰਮਣਾ ਜਾਂ ਕਈ ਵਾਰ ਜਿਹੜੀਆਂ ਬਾਹਾਂ ਨੇਗੀਆਂ ਉਹਨੂੰ ਹੁਲਾਰਾ ਦੇਣਾ ਬਾਹਾਂ ਨੂੰ ਦੋਨਾਂ ਨੇ ਇੱਕ ਪਾਸੇ ਲੈ ਕੇ ਜਾਣਾ ਜਾਂ ਦੂਸਰੇ ਪਾਸੇ ਲੈ ਕੇ ਜਾਣਾ ਜਾਂ ਕਈ ਵਾਰ ਇੱਕ ਬਾਂਹ ਨੂੰ ਲੱਕ ਉੱਪਰ ਧਰਨਾ ਤਾਂ ਦੂਜੀ ਬਾਂਹ ਨੂੰ ਖੜ੍ਹੀ ਕਰਨਾ ਤਾਂ ਇਹ ਵੀ ਹੈਗਾ ਕਈ ਵਾਰ ਦੋਨਾਂ ਪ ਪ ਪੰਜਾਂ ਦੇ ਉੱਪਰ ਬੈਠ ਕੇ ਦੁਬਾਰਾ ਉੱਠਣਾ ਪੱਬਾਂ ਦੇ ਭਾਰ ਨਾਲ ਕਈ ਵਾਰ ਗੋਡਿਆਂ ਭਾਰ ਜਾ ਬੈਠ ਕੇ ਜਾਂ ਹੌਲੀ ਹੌਲੀ ਡੱਡੂ ਵਾਂਗ ਟਪੂਸੀਆਂ ਮਾਰਨੀਆਂ ਤਾਂ ਟਪੂਸੀਆਂ ਮਾਰ ਮਾਰ ਕੇ ਅੱਗੇ ਉਹ ਕਰਨਾ ਕਈ ਵਾਰ ਡਾਂਗ ਰੱਖ ਕੇ ਮੋਢੇ ਦੇ ਉੱਪਰ ਉਹ ਕਰਨਾ ਤਾਂ ਜਾਂ ਕਈ ਵਾਰ ਪੱਟਾਂ ਦੇ ਉੱਪਰ ਥਾਪੀ ਮਾਰਨੀ ਤਾਂ ਭੰਗੜਾ ਪੱਟ ਦੇ ਜ਼ੋਰ ਨਾਲ ਤਾਂ ਇਸ ਤਰ੍ਹਾਂ ਅਲੱਗ ਅਲੱਗ ਕਰਕੇ ਜਾਂ ਇੱਕ ਲੱਤ ਚੱਕ ਕੇ ਉੱਪਰ ਦੋਨੇ ਬਾਹਾਂ ਖੜ੍ਹੀਆਂ ਕਰਕੇ ਭੰਗੜਾ ਪੈਂਦਾ ਹੈਗਾ ਤਾਂ ਫਿਰ ਉਹ ਤੋਂ ਬਾਅਦ ਦੂਜੀ ਲੱਤ ਜਿਹੜੀ ਥੱਲੇ ਹੁੰਦੀ ਹੈਗੀ ਉਹਨੂੰ ਉਤਾਹਾਂ ਚੱਕ ਕੇ ਤਾਂ ਜਿਹੜੀ ਚੱਕੀ ਹੁੰਦੀ ਉਹਨੂੰ ਥੱਲੇ ਉਸੇ ਦੇ ਉੱਤੇ ਭਾਰ ਦੇ ਕੇ ਆਪਦਾ ਚ ਗੋਲ ਚੱਕਰ ਨਾਲ ਗੇੜਾ ਦੇਣਾ ਤਾਂ ਉਹ ਬੈਠਣਾ ਹੁੰਦਾ ਹੈਗਾ ਤਾਂ ਜਾਂ ਫਿਰ ਲੱਕ ਦੇ ਉੱਪਰ ਹੱਥ ਰੱਖ ਕੇ ਭੰਗੜਾ ਪਾਉਣਾ ਕਈ ਵਾਰ ਦੋਨੇ ਹੱਥ ਰੱਖਦੇ ਹੈਗੇ ਅਤੇ ਅਸੀਂ ਉਹ ਝੂਲਦੇ ਵੀ ਆਉਂਦੇ ਜਿਵੇਂ ਹਵਾ ਵਿੱਚ ਝੂਲਦੇ ਹੁੰਦੇ ਹੈਗੇ ਤਾਂ ਇਸ ਤਰ੍ਹਾਂ ਕਰਕੇ ਉਹਨੂੰ ਝੂਲਣਾ ਹੁੰਦਾ ਗਾ ਭੰਗੜੇ ਦੇ ਵਿੱਚ ਅਤੇ ਜਾਂ ਫਿਰ ਇੱਕ ਲੱਤ ਇੱਕ ਹੱਥ ਜਿਹੜਾ ਭੰਗੜੇ ਲੱਕ ਦੇ ਉੱਪਰ ਰੱਖ ਕੇ ਦੂਜੇ ਹੱਥ ਨਾਲ ਉਤਾਂਹ ਖੜ੍ਹੇ ਹੋ ਕੇ ਭੰਗੜਾ ਪਾਉਂਦਾ ਗਾ ਜਾਂ ਫਿਰ ਦੋਨੇ ਬਾਹਾਂ ਖੜ੍ਹੀਆਂ ਕਰਕੇ ਅਸੀਂ ਭੰਗੜਾ ਜਿਹੜਾ ਪਾ ਸਕਦੇ ਹਾਂਗੇ ਇਹ ਭੰਗੜੇ ਦੇ ਆਮ ਸਟੈਪ ਨੇਗੇ ਅਤੇ ਪੰਜਾਬੀ ਸੱਭਿਆਚਾਰ ਦੇ ਵਾਲੇ ਸੁਭਾਅ ਵਿੱਚ ਕਿਵੇਂ ਯੋਗਦਾਨ ਪਾਉਂਦੇ ਨੇਗੇ ਤਾਂ ਇਹਦੇ ਵਿੱਚ ਜਿੰਨੇ ਜ਼ੋਰ ਦੀ ਸੌਂਗ ਹੁੰਦਾ ਜਾਂ ਜਿੰਨੇ ਜ਼ੋਰ ਦੀ ਨੱਚਿਆ ਜਾਂਦਾ ਗਾ ਤਾਂ ਉਸ ਹਿਸਾਬ ਨਾਲ ਇਹ ਜ਼ੋਰਦਾਰ ਅਤੇ ਜਸ਼ਨ ਵਾਲਾ ਸੁਭਾਵ ਬਣਦਾ ਹੈਗਾ ਅਤੇ ਸੁਭਾਅ ਦੇ ਵਿੱਚ ਇਹਦੇ ਵਿੱਚ ਬਹੁਤ ਐਕਟਿਵ ਮੋਡ ਦੇ ਵਿੱਚ ਇਹ ਨੱਚਿਆ ਜਾਂਦਾ ਗਾ ਤਾਂ ਉਸ ਹਿਸਾਬ ਨਾਲ ਭੰਗੜਾ ਜਿਹੜਾ ਹੈਗਾ ਸਰੀਰ ਦੇ ਹਿਸਾਬ ਦੇ ਨਾਲ ਵੀ ਸਰੀਰ ਰਿਸ਼ਟ ਪੁਸ਼ਟ ਹੋਣਾ ਚਾਹੀਦਾ ਫੇਰ ਹੀ ਪੱਟਾਂ ਦੇ ਜ਼ੋਰ ਨਾਲ ਭੰਗੜਾ ਪੈਂਦਾ ਹੈਗਾ ਜੀ